ਅਸੀਂ ਪੰਜਾਬੀ ਲੋਕ ਆਪਣੀ ਪਛਾਣ ਦੱਸਣ ਵਾਸਤੇ ਸਭ ਨਾਲ ਗੱਲਾਂ ਜਿਹਨੂੰ ਮਿਲਦੇ ਹਾਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਉਸ ਤੋਂ ਉਪਰੰਤ ਕੋਈ ਵੀ ਕਿਸੇ ਪਾਸਿਓਂ ਕਿਸੇ ਵੀ ਸਟੇਟ ਦਾ ਜਾਂ ਕਿਸੇ ਸ਼ਹਿਰ ਤੋਂ ਆਇਆ ਹੋਏਗਾ ਬੰਦਾ ਉਹਨੂੰ ਜਦੋਂ ਮਿਲਦੇ ਹਾਂ ਅਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਹੋਰ ਫਿਰ ਕੋਈ ਗੁਰਸਿੱਖ ਭਰਾ ਮਿਲ ਜਾਵੇ ਉਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ ਜੋ ਸਾਡੇ ਗੁਰੂ ਸਾਹਿਬਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਕਿਸੇ ਵੀ ਹੋਰ ਮੁਲਕ ਵਿੱਚ ਬਾਹਰ ਜਾ ਕੇ ਵੀ ਕਿਸੇ ਨਾਲ ਵੀ ਜੋ ਗੱਲ ਕਰਨੀ ਤਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਕੋਲਜ 'ਚ ਅਸੀਂ ਆਪਣੀ ਪੰਜਾਬੀ ਪੰਜਾਬ ਦੀ ਪਹਿਚਾਣ ਕਰਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਆਏ ਹਾਂ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਬੋਲ ਕੇ ਫਿਰ ਉਹਨਾਂ ਨੂੰ ਸਾਰਾ ਦੱਸਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚੋਂ ਆਏ ਹਾਂ ਅਤੇ ਪੰਜਾਬੀ ਬਾਰੇ ਤੁਹਾਨੂੰ ਇਸ ਤਰ੍ਹਾਂ ਅਸੀਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ